ਮੈਂ ਆਪਣੇ ਮਾਸੀ ਜੀ ਦੇ ਕੋਲ ਸ਼ਹਿਰ ਦਿੱਲੀ ਜਾਣਾ ਚਾਹੁੰਦੀ ਸੀ ਕਿਉਂਕੀ ਮੇਰੀ ਮਾਸੀ ਜੀ ਵਿਆਹੇ ਹੋਏ ਦਿੱਲੀ ਵਿਆਹੇ ਹੋਏ ਸਨ ਅਤੇ ਮੈਂ ਬਰਨਾਲੇ ਸ਼ਹਿਰ ਦੀ ਰਹਿਣ ਵਾਲੀ ਹਾਂ ਮੇਰੇ ਮਾਸੀ ਜੀ ਨੇ ਮੈਨੂੰ ਉੱਥੇ ਦਿੱਲੀ ਮਿਲਣ ਅਤੇ ਘੁੰਮਣ ਫਿਰਨ ਲਈ ਬੁਲਾਇਆ ਸੀ ਅਤੇ ਮੈਂ ਮੈਂ ਸੋਚਿਆ ਕਿ ਮੈਂ ਦਿੱਲੀ ਜਾਣ ਲਈ ਰੇਲਗੱਡੀ ਰੇਲਗੱਡੀ ਦਾ ਸਫ਼ਰ ਤੈਅ ਕਰਾਂਗੀ ਅਤੇ ਰੇਲਗੱਡੀ 'ਤੇ ਜਾਣ ਲਈ ਜਾਣ ਲਈ ਯਾਤਰਾ ਕਰਾਂਗੀ ਅਤੇ ਰੇਲਗੱਡੀ ਦਾ ਸਮਾਂ ਸਾਰਣੀ ਕੀ ਸੀ ਅਤੇ ਉਸ ਵਿੱਚ ਕੀ ਸਹੂਲਤਾਂ ਹਨ ਮੈਂ ਪੁੱਛਣਾ ਚਾਹੁੰਦੀ ਹਾਂ ਇਸ 'ਚ ਕੀ ਖਾਣ ਪੀਣ ਬਾਰੇ ਹੈ ਅਤੇ ਮੈਂ ਉਨ੍ਹਾਂ ਚੀਜ਼ਾਂ ਉਨ੍ਹਾਂ ਗੱਲਾਂ ਨੂੰ ਜਾਨਣਾ ਚਾਹੁੰਦੀ ਹਾਂ ਅਤੇ ਕਿ ਦਿੱਲੀ ਜਾ ਕੇ ਮੈਂ ਉੱਥੇ ਬਹੁਤ ਚੀਜ਼ਾਂ ਦੇਖੀਆਂ ਅਤੇ ਘੁੰਮੀ ਫਿਰੀ ਮੈਂ ਮਾਮੀ ਮਾਸੀ ਜੀ ਨਾਲ ਸ਼ੋਪਿੰਗ ਵਗੈਰਾ ਅਤੇ ਹੋਰ ਕਈ ਚੀਜ਼ਾਂ ਵੀ ਵੇਖੀਆਂ ਅਤੇ ਕਈ ਸਥਾਨਾਂ 'ਤੇ ਵੀ ਘੁੰਮੀ ਫਿਰੀ ਜਿਵੇਂ ਇੰਡੀਆ ਗੇਟ ਜ਼ਿਲ੍ਹਿਆਂ ਵਾਲਾ ਔਰ ਉਹ ਅਤੇ ਚਿੜੀਆ ਘਰ ਅਤੇ ਔਰ ਔਹ ਜਗ੍ਹਾ 'ਤੇ ਵੀ ਘੁੰਮੀ ਫਿਰੀ ਸੀ ਕੇ ਮੈਨੂੰ ਬਹੁਤ ਹੀ ਘੁੰਮ ਫਿਰ ਕੇ ਬਹੁਤ ਵਧੀਆ ਮਹਿਸੂਸ ਫੀਲ ਹੋਇਆ ਅਤੇ ਮੈਂ ਉਸ ਜਗ੍ਹਾ 'ਤੇ ਘੁੰਮ ਫਿਰ ਕੇ ਬਹੁਤ ਵਧੀਆ ਮਹਿਸੂਸ ਕਰਦੀ ਸੀ ਕਿ ਮੈਂ ਦਿੱਲੀ ਦਾ ਸਫ਼ਰ ਰੇਲਗੱਡੀ ਦੇ ਰਾਹੀਂ ਤੈਅ ਕੀਤਾ ਸੀ ਅਤੇ ਤਾਂ ਰੇਲਗੱਡੀ ਦਾ ਸਫ਼ਰ ਤੈਅ ਕਰਨ ਵਿੱਚ ਕੋਈ ਦਿੱਕਤ ਪ੍ਰੇਸ਼ਾਨੀ ਨਹੀਂ ਆਉਂਦੀ ਕਿਉਂਕਿ ਰੇਲਗੱਡੀ ਵਿੱਚ ਸਫ਼ਰ ਕਰਨ ਲਈ ਸਫ਼ਰ ਕਰਨ ਲਈ ਆਪਾਂ ਨੂੰ ਕੋਈ ਵੀ ਪ੍ਰੋਬਲਮ ਨਹੀਂ ਹੁੰਦੀ ਕਿਉਂਕਿ ਸਮਾਂ ਸਾਰਨੀ ਦੇ ਅਨੁਸਾਰ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਸਮਾਂ ਕੀ ਹੈ ਰੇਲਗੱਡੀ ਦੇ ਆਉਣ ਜਾਣ ਦਾ ਅਤੇ ਰੁੱਕਣ ਦਾ ਅਤੇ ਉਸ ਵਿੱਚ ਕੀ ਖਾਣ ਪੀਣ ਦੀ ਸਹੂਲਤਾਂ ਹਨ ਅਤੇ ਮੈਂ ਉਨ੍ਹਾਂ ਚੀਜ਼ਾਂ ਬਾਰੇ ਦੱਸੋ ਪੁੱਛਣਾ ਚਾਹੁੰਦੀ ਹਾਂ ਕਿ ਇਨ੍ਹਾਂ ਇਸ ਰੇਲਗੱਡੀ ਵਿੱਚ ਹੋਰ ਵੀ ਜ਼ਿਆਦਾ ਸਹੂਲਤਾਂ ਹਨ ਅਤੇ ਕਿਹੜੇ ਸਟੇਸ਼ਨਾਂ 'ਤੇ ਰੁੱਕਦੀ ਹੈ